ਪੰਜਾਬ ਵਿੱਚ ਹਰ ਪ੍ਰਕਾਰ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦਾ ਆਪਣਾ ਧਰਮ ਅਤੇ ਸੱਭਿਆਚਾਰ ਹੈ ਜੀਵਨ ਜਿਉਣ ਦਾ ਢੰਗ ਵੀ ਵੱਖਰਾ ਵੱਖਰਾ ਹੈ ਰੁਜ਼ਗਾਰ ਦੀ ਕਮੀ ਕਰਕੇ ਵੀ ਬੇਰੁਜ਼ਗਾਰੀ ਵੱਧ ਰਹੀ ਹੈ ਅਤੇ ਗਰੀਬੀ ਵੀ ਵੱਧ ਰਹੀ ਹੈ ਪੰਜਾਬ ਵਿੱਚ ਜਾਤ ਪਾਤ ਅਤੇ ਧਰਮ ਦਾ ਕਾਫੀ ਭੇਦਭਾਵ ਹੋਣ ਲੱਗ ਗਿਆ ਹੈ ਪਰ ਪ੍ਰਸ਼ਾਸਨ ਇਹਨਾਂ ਸਭ ਮੁੱਦਿਆਂ ਨੂੰ ਹੱਲ ਕਰਨ ਲਈ ਸਮੇਂ ਸਮੇਂ ਉੱਤੇ ਸੈਮੀਨਾਰ ਧਾਰਮਿਕ ਸੱਭਿਆਚਾਰ ਪ੍ਰੋਗਰਾਮ ਰੁਜ਼ਗਾਰ ਮੇਲਿਆਂ ਦਾ ਪ੍ਰਬੰਧ ਕਰਦਾ ਰਹਿੰਦਾ ਹੈ ਤਾਂ ਜੋ ਲੋਕਾਂ ਵਿੱਚ ਆਪਸੀ ਮਿਲਵਰਤਣ ਵਧੇ ਅਤੇ ਬੇਰੁਜ਼ਗਾਰੀ ਨੂੰ ਅਤੇ ਗਰੀਬੀ ਨੂੰ ਦੂਰ ਕੀਤਾ ਜਾ ਸਕੇ